ਯੋਗ ਭਾਰਤੀ ਸੰਸਕ੍ਰਿਤੀ ਦੀ ਪਹਿਚਾਨ ਯੋਗ ਗੁਰੂ ਪਤੰਜਲੀ ਗਿਆ ਹੈ ਜਿਹਦੇ ਵਿੱਚ ਕਹਿ ਸਕਦੇ ਆ ਆਪਾਂ ਜਿਦਾਂ ਮੇਰਾ ਆਪਣਾ ਖੁਦ ਦਾ ਅਨੁਭਵ ਹੈ ਕਰੋਨਾ ਦੌਰਾਨ ਜਦ ਮੈਂ ਘਰ ਦੇ ਵਿੱਚ ਇਕੱਲਾ ਹੀ ਸੀ ਚਾਰੋ ਪਾਸੇ ਬੰਦ ਸੀਗਾ ਤਾਂ ਆਪਾਂ ਕਾਫੀ ਪਰੇਸ਼ਾਨ ਹੋ ਗਏ ਸੀ ਡਿਪਰੈਸ਼ਨ ਦੇ ਸ਼ਿਕਾਰ ਹੋਏ ਸੀ ਜਿਹਦੇ ਵੀ ਸਾਨੂੰ ਯੋਗ ਦੇ ਬਾਰੇ ਪਤਾ ਲੱਗਿਆ ਨਿਊਜ ਚੈਨਲ ਤੋਂ ਟੀਵੀ ਤੋਂ ਤੇ ਕਿਆ ਕੀ ਯੋਗ ਨਾਲ ਤੁਸੀਂ ਇਮਿਊਨਟੀ ਬਣਾ ਸਕਦੇ ਹੋ ਆਪਣੀ ਕਾਫੀ ਆਪਣੀ ਡਿਪਰੈਸ਼ਨ ਨੂੰ ਘੱਟ ਕਰ ਸਕਦੇ ਹੋ ਇਹਦੇ ਵਿੱਚ ਸਾਨੂੰ ਯੋਗ ਦੇ ਬਾਰੇ ਕਾਫੀ ਪਤਾ ਲੱਗ ਜਾਦਾ ਜਿਹਦੇ ਵਿੱਚ ਜਿਵੇਂ ਯੋਗ ਨੂੰ ਅਪਣਾਇਆ ਤੇ ਯੋਗ ਸੁਰੂ ਕੀਤਾ ਤੇ ਯੋਗ ਸ਼ੁਰੂ ਕਰਕੇ ਸਾਨੂੰ ਕਾਫੀ ਬੈਨੀਫਿਟ ਹੋਇਆ ਪਹਿਲੇ ਤੇ ਸਾਨੂੰ ਪਤਾ ਨਹੀਂ ਸੀ ਪ੍ਰਕਿਰਿਆ ਹੈ ਕਿਆ ਫਿਰ ਉਸ ਬਾਰੇ ਆਪਾਂ ਨੇ ਪੜਨਾ ਸ਼ੁਰੂ ਕੀਤਾ ਕੀ ਯੂਟੀਊਬ ਤੇ ਰੀਸਰਚ ਕਰਿਆ ਅਲਗ ਅਲਗ ਆਸਨ ਦੇਖੇ ਉਥੋਂ ਸਾਨੂੰ ਪਤਾ ਲੱਗਿਆ ਕੀ ਯੋਗ ਹੈ ਕੀ ਤੇ ਬੈਨੀਫਿਟਸ ਕੀ ਹੈ ਸਾਨੂੰ ਬਹੁਤ ਸਾਰੇ ਬਿਮਾਰੀਆਂ ਤੋਂ ਯੋਗ ਬਚਾਉਂਦਾ ਹੈ ਦਵਾਈਆਂ ਤੇ ਜਿਹੜੇ ਡਿਪੈਂਡ ਸੀਗੇ ਉਹਨੂੰ ਦਵਾਈਆਂ ਤੋਂ ਦੂਰ ਕਰਨ ਵਾਸਤੇ ਯੋਗ ਕਾਫੀ ਲਾਭਵੰਦ ਹੋਇਆ ਤੇ ਮੈਂ ਵੀ ਯੋਗ ਬਾਰੇ ਪੜ੍ਹ ਕੇ ਦੇਖ ਕੇ ਇਸ ਦਾ ਕੁਛ ਫਿਰ ਯੋਗ ਕਰਨ ਦਾ ਮਨ ਬਣਾਇਆ ਸੀਗਾ ਪਹਿਲੇ ਪਹਿਲੇ ਤੋਂ ਸ਼ੁਰੂ ਦੇ ਵਿੱਚ ਬੜਾ ਅਜੀਬ ਜਿਹਾ ਲੱਗਦਾ ਸੀਗਾ ਆਸਨ ਕਰਨਾ ਨਹੀਂ ਆਉਂਦਾ ਸੀਗਾ ਆਸਨ ਦੀ ਕਿਰਿਆ ਵੀ ਕਿਵੇਂ ਕਰਨਾ ਪਤਾ ਹੀ ਨਹੀਂ ਸੀ ਬਟ ਯੂਟੀਊਬ ਦੀ ਸਹਾਇਤਾ ਨਾਲ ਮੈਂ ਯੋਗ ਕਰਨਾ ਸ਼ੁਰੂ ਕੀਤਾ ਯੋਗ ਦੇ ਵਿਚ ਪਹਿਲੇ ਕੀ ਮੈਨੂੰ ਸੂਰਿਆ ਨਮਸਕਾਰ ਬਾਰੇ ਪਤਾ ਲੱਗਿਆ ਸੂਰਿਆ ਨਮਸਕਾਰ ਭਾਰ ਯੋਗ ਦਾ ਇਕੀ ਕਿਰਿਆ ਹੈ ਜਿਹਦੇ ਵਿੱਚ ਆਪਾਂ ਕਰੀਏ ਤਾਂ ਪੂਰੀ ਕਿਰਿਆ ਕਰਨ ਵੇਲੇ ਸਾਨੂੰ ਕਾਫੀ ਹੱਦ ਤੱਕ ਬੈਨੀਫਿਟ ਮਿਲਦੀ ਹੈ ਜਿਹਦੇ ਵਿੱਚ ਅਗਰ ਸੂਰਿਆ ਨਮਸਕਾਰ ਰੋਜ਼ ਆਪਾਂ ਅੱਧਾ ਘੰਟਾ ਕਰੀਏ ਤਾਂ ਬਾਰਾ ਆਸਨ ਇਹ ਕਿਰਿਆ ਦੇ ਵਿੱਚ ਪੂਰੇ ਹੁੰਦੇ ਹੈ ਠੀਕ ਹੈ ਤੇ ਇਹ ਸੂਰਿਆ ਨਮਸਕਾਰ ਕਰਨ ਨੂੰ ਸਾਨੂੰ ਘੱਟੋ ਘੱਟ ਦੋ ਮਿੰਟ ਦਾ ਸਮੇਂ ਲੱਗਦਾ ਠੀਕ ਹੈ ਜੀ ਤੇ ਇਸੀ ਤਰਾਂ ਆਪਾਂ ਘੱਟੋ ਘੱਟ ਦਸ ਕਿਰਿਆ ਕਰੀਏ ਦਸ ਦਿਨਾਂ ਵੀਹ ਮਿੰਟ ਦੇ ਵਿੱਚ ਆਪਾਂ ਬਾਰਾ ਵਾਰ ਚੋਬੀ ਕਿਰਿਆ ਕਰ ਸਕਦੇ ਹੈ ਜਿਹਦੇ ਕੀ ਸਾਨੂੰ ਕਾਫੀ ਲਾਭਵੰਦ ਹੋਊਗਾ ਠੀਕ ਐ ਇਹਦੇ ਵਿੱਚ ਜਿਹੜੇ ਕਰਕੇ ਮੈਨੂੰ ਡਿਪਰੈਸ਼ਨ ਤੋਂ ਕਾਫੀ ਲਾਭ ਮਿਲਿਆ ਠੀਕ ਹੈ ਜੀ ਮਨ ਸ਼ਾਂਤ ਹੋਇਆ ਪੜਾਈ ਦੇ ਵਿੱਚ ਮਨ ਲੱਗਣ ਲੱਗ ਪਿਆ ਸੀ ਠੀਕ ਹੈ ਤੇ ਆਪਣੇ ਆਪ ਨੂੰ ਖੁਸ਼ਾ ਮਿਜ਼ਾਜ਼ ਕਰ ਲਿਆ ਵਾ ਕਾਫੀ ਥਕਾਵਟ ਤੋਂ ਰਲੀਫ ਮਿਲੀ ਮੈਨੂੰ ਉਸ ਤੋਂ ਬਾਅਦ ਸੂਰਿਆ ਨਮਸਕਾਰ ਕਰਨ ਨਾਲ ਸਾਨੂੰ ਕਾਫੀ ਲਾਭ ਹੋਇਆ ਜਿਹਦੇ ਵਿੱਚ ਉਸ ਤੋਂ ਬਾਅਦ ਮੈਂ ਆਪਣੇ ਘਰਦਿਆ ਨੂੰ ਵੀ ਆਪਣੀ ਮੰਮੀ ਪਾਪਾ ਦੀਦੀ ਉਹਨਾਂ ਨੂੰ ਵੀ ਯੋਗਾ ਬਾਰੇ ਦੱਸਿਆ ਤੇ ਆਪਾਂ ਸਾਰੇ ਮਿਲ ਕੇ ਲੋਕਡਾਊਨ ਦੇ ਦੌਰਾਨ ਉਹਨਾਂ ਨਾਲ ਸਾਰੇ ਆਪਾਂ ਮਿਲ ਕੇ ਯੋਗਾ ਕਰਦੇ ਸੀਗੇ ਸਵੇਰ ਦਾ ਟਾਈਮ ਸੀਗਾ ਸਵੇਰੇ ਯੋਗਾ ਕਰਦੇ ਸੀਗੇ ਇਹਦੇ ਵੀ ਸਾਨੂੰ ਜੋ ਬੈਨੀਫਿਟਸ ਮਿਲਿਆ ਉਹ ਆਪਾਂ ਫਿਰ ਲੋਕਾਂ ਨੂੰ ਆਪਣੇ ਪੜੋਸੀ ਗੁਆਂਡੀਆਂ ਨੂੰ ਵੀ ਦੱਸਿਆ ਤੇ ਉਹਨਾਂ ਨੂੰ ਵੀ ਕਾਫੀ ਇਹਦਾ ਬੈਨੀਫਿਟ ਮਿਲਿਆ ਤੇ ਜਿਹੜੇ ਨਵੇਂ ਲੋਕ ਹੈਗੇ ਜਿਹੜੇ ਉਹਨਾਂ ਨੂੰ ਮੈਂ ਇਹੀ ਕਹੂੰਗਾ ਕੀ ਯੋਗ ਕਰਨ ਨਾਲ ਸਰੀਰ ਬਿਲਕੁਲ ਨਿਊ ਓਵਰ ਰਹਿ ਸਕਦਾ ਹੈ ਨਿਰੋਗ ਰਹਿ ਸਕਦਾ ਸਾਨੂੰ ਦਵਾਈਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਫੈਟ ਤੋਂ ਮਿਲ ਸਕਦਾ ਇੰਟਰਨਲੀ ਪਾਵਰ ਕਾਫੀ ਸਟਰੋਂਗ ਹੋ ਸਕਦਾ ਠੀਕ ਹੈ ਕਾਫੀ ਸਟਰੋਂਗ ਹੈ ਤੇ ਇਸ ਲਈ ਸਾਨੂੰ ਥੋੜੇ ਥੋੜੇ ਯੋਗ ਕਰਨਾ ਆ ਕਰਨਾ ਚਾਹੀਦਾ ਸਵੇਰੇ ਉੱਠ ਕੇ ਜਿਹਦੇ ਕਰਕੇ ਸਾਨੂੰ ਸਾਹ ਦੇ ਵਿੱਚ ਕਾਫੀ ਸਾਭ ਮਿਲ ਸਕਦਾ ਹੈ ਠੀਕ ਹੈ ਜੇ ਇਹ ਨਹੀਂ ਕਹਿ ਸਕਦੇ ਕਿ ਆਪਾਂ ਤੁਸੀਂ ਸਾਰੇ ਯੋਗਾ ਇਕੱਠੀ ਸ਼ੁਰੂ ਕਰੋ ਪਰ ਹਾਂ ਥੋੜਾ ਥੋੜਾ ਸ਼ੁਰੂ ਕਰੋ ਜਿਸ ਵਿਚ ਥੋੜਾ ਥੋੜਾ ਆਪਾਂ ਸ਼ੁਰੂ ਕਰਾਂਗੇ ਤੇ ਇੱਕ ਹੈਬਿਟ ਬਨਦੀ ਐ ਤੇ ਫਿਰ ਆਪਾਂ ਅੱਗੇ ਜਾ ਕੇ ਉਹਨੂੰ ਖਾ ਕੇ ਆਪਣੀ ਜਿੰਦਗੀ ਵਿੱਚ ਬਦਲਾਵ ਲਿਆ ਸਕਦੇ ਆ ਤੇ ਇਹਦੇ ਕਰਕੇ ਸਾਨੂੰ ਖਾਣ ਪਾਣ 'ਚ ਵੀ ਕਾਫੀ ਫਰਕ ਉਸਤੋਂ ਬਾਅਦ ਆਪਾਂ ਜਿਵੇਂ ਡਿਪਰੈਸ਼ਨ ਹੋ ਰਿਹਾ ਤਾਂ ਮੈਡੀਟੇਸ਼ਨ ਕਰਨਾ ਸ਼ੁਰੂ ਕਰੀਏ ਮੈਡੀਟੇਸ਼ਨ ਨਾਲ ਸਾਨੂੰ ਕਾਫੀ ਰਿਲੀਫ ਮਿਲਦਾ ਜਿਹਦੇ ਕਰਕੇ ਸਾਨੂੰ ਮਨ ਦੀ ਕਾਫੀ ਸ਼ਾਂਤੀ ਮਿਲਦੀ ਐ ਇਸ ਲਈ ਯੋਗ ਇਕ ਬਹੁਤ ਹੀ ਅੱਛੀ ਪ੍ਰਕਿਰਿਆ ਹੈ ਤੇ ਮੈਂ ਨਵੇਂ ਲੋਕਾਂ ਨੂੰ ਵੀ ਸਲਾਹ ਇਹੀ ਦੇਊਗਾ ਕੀ ਤੁਸੀਂ ਯੋਗ ਕਰੋ ਔਰ ਨਿਰੋਗ ਰਹੋ ਤੇ ਯੋਗ ਕਰਨਾ ਕੋਈ ਇੱਡੀ ਗੱਲ ਨਹੀਂ ਬਸ ਇਹਨੂੰ ਸਮਝਣ ਲਈ ਜਦੋਂ ਤੁਸੀਂ ਸਮਝ ਜਾਓਗੇ ਯੋਗ ਕਰੋਗੇ ਆਪਾਂ ਦੇਖ ਸਕਦੇ ਫੀ ਲਾਕਡਾਊਨ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਜਦੋਂ ਕਿ ਆਪਾਂ ਹੋਸਪਿਟਲ ਬੰਦ ਸੀਗੇ ਸਾਰਾ ਮੈਡੀਸਨ ਬੰਦ ਸੀਗਾ ਫਿਰ ਲੋਕੀ ਕੀ ਹੈ ਆਪਣੇ ਆਪ ਨੂੰ ਸਟਰੋਂਗ ਕਰਨ ਲਈ ਮੋਟੀਵੇਟ ਕਰਨ ਲਈ ਯੋਗ ਦੀ ਸਾਥ ਲਿਆ ਔਰ ਯੋਗ ਕਰਕੇ ਕਾਫੀ ਆਪਣੇ ਆਪ ਨੂੰ ਦਰੁਸਤ ਰੱਖਿਆ ਇਹਦੇ ਵਿੱਚ ਫਿਰ ਸਾਨੂੰ ਕਾਫੀ ਲਾਭ ਹੋਇਆ ਤੇ ਸਾਨੂੰ ਵੀ ਯੋਗ ਦੇ ਬਾਰੇ ਜਾਗਰੂਕ ਹੋਣਾ ਚਾਹੀਦਾ ਤੇ ਘੱਟੋ ਘੱਟ ਸਾਨੂੰ ਇਹ ਇਕ ਤਾਂ ਸਲਾਹ ਸੂਰਿਆ ਨਸਕਾਰ ਦਸ ਵਾਰੀ ਜਰੂਰ ਕਰੋ ਜਿਹੜਾ ਜਿਹੜਾ ਸਾਨੂੰ ਕਾਫੀ ਲਾਭ ਹੋ ਸਕਦਾ ਹੈ